ਭੰਗੜਾ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਅਤੇ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਭੰਗੜਾ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ ਇਹ ਨਾ ਸਿਰਫ ਇਕ ਨਾਚ ਹੈ ਸਗੋਂ ਖੁਸ਼ੀ ਉਤਸ਼ਾਹ ਅਤੇ ਜੀਵਨ ਦੇ ਜਸ਼ਨ ਦਾ ਪ੍ਰਤੀਕ ਵੀ ਹੈ ਆਓ ਦੇਖੀਏ ਕਿ ਭੰਗੜਾ ਪੰਜਾਬੀ ਸੱਭਿਆਚਾਰ ਵਿੱਚ ਕਿਉਂ ਇੰਨਾ ਮਹੱਤਵਪੂਰਨ ਹੈ ਅਤੇ ਸਮੇਂ ਦੇ ਨਾਲ ਕਿਵੇਂ ਪੰਜਾਬੀ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ ਭੰਗੜੇ ਦੀ ਮਹੱਤਤਾ ਖੁਸ਼ੀ ਦਾ ਪ੍ਰਗਟਾਵਾ ਭੰਗੜਾ ਖੁਸ਼ੀ ਉਤਸ਼ਾਹ ਅਤੇ ਜੀਵਨ ਦੇ ਜਸ਼ਨ ਦਾ ਪ੍ਰਗਟਾਵਾ ਹੈ ਇਹ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਆਰਾਮ ਕਰਨ ਅਤੇ ਖੁਸ਼ੀ ਮਨਾਉਣ ਦਾ ਇੱਕ ਤਰੀਕਾ ਸੀ ਸੱਭਿਆਚਾਰਕ ਪਛਾਣ ਭੰਗੜਾ ਪੰਜਾਬੀ ਸੱਭਿਆਚਾਰ ਦੀ ਪਛਾਣ ਹੈ ਇਹ ਪੰਜਾਬੀਆਂ ਦੀ ਮਿਹਨਤ ਲਚਕੀਲੇਪਣ ਅਤੇ ਖੁਸ਼ੀ ਦਾ ਪ੍ਰਤੀਕ ਹੈ ਸਮਾਜਿਕ ਬੰਧਨ ਭੰਗੜਾ ਲੋਕਾਂ ਨੂੰ ਇਕੱਠਾ ਕਰਦਾ ਹੈ ਅਤੇ ਸਮਾਜਿਕ ਬੰਧਨ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਤਿਉਹਾਰਾਂ ਅਤੇ ਵਿਆਹਾਂ ਵਿਚ ਲੋਕਾਂ ਨੂੰ ਇੱਕ ਦੂਜੇ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ ਸਰੀਰ ਦੇ ਮਨ ਲਈ ਫਾਇਦੇਮੰਦ ਭੰਗੜਾ ਇੱਕ ਸਰੀਰਕ ਗਤੀਵਿਧੀ ਹੈ ਜੋ ਸਰੀਰ ਤੰਦਰੁਸਤ ਰੱਖਦੀ ਹੈ ਅਤੇ ਮਨ ਨੂੰ ਖੁਸ਼ ਰੱਖਦੀ ਹੈ ਪੰਜਾਬੀ ਸੰਗੀਤ ਦਾ ਪ੍ਰਚਾਰ ਭੰਗੜਾ ਪੰਜਾਬੀ ਸੰਗੀਤ ਨੂੰ ਦੁਨੀਆਂ ਭਰ ਵਿੱਚ ਪ੍ਰਸਿੱਧ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਭੰਗੜਾ ਅਤੇ ਪੰਜਾਬੀ ਤਿਉਹਾਰਾਂ ਭੰਗੜਾ ਹੁਣ ਪੰਜਾਬੀ ਤਿਉਹਾਰਾਂ ਦਾ ਅਨਿਖੜਵਾਂ ਅੰਗ ਬਣ ਗਿਆ ਹੈ ਲੋਕ ਵਿਸਾਖੀ ਦੀਵਾਲੀ ਲੋਹੜੀ ਅਤੇ ਹੋਰ ਤਿਉਹਾਰਾਂ ਦੌਰਾਨ ਭੰਗੜੇ ਦਾ ਆਨੰਦ ਲੈਂਦੇ ਹਨ ਭੰਗੜੇ ਨੇ ਨਾ ਸਿਰਫ ਪੰਜਾਬੀ ਵਿੱਚ ਸਗੋਂ ਦੁਨੀਆ ਭਰ ਵਿੱਚ ਪੰਜਾਬੀਆਂ ਨੇ ਇਕੱਠਾ ਕਰਨ ਵਿੱਚ ਮਹੱਤਵਪੂਰਨ ਨਿਭਾਈ ਹੈ ਭੰਗੜਾ ਅੱਜ ਦੀ ਦੁਨੀਆ ਦੇਸ਼ਾ ਵਿਦੇਸ਼ਾਂ ਤੱਕ ਫੈਲ ਗਿਆ ਹੈ ਇਸ ਦੀ ਬਹੁਤ ਦੇਸ਼ਾਂ ਵਿਦੇਸ਼ਾਂ ਤੱਕ ਭੂਮਿਕਾ ਹੈ ਕਿ ਜਿਵੇਂ ਆਸਟਰੇਲੀਆ ਕੈਨੇਡਾ ਅਮਰੀਕਾ ਵਿੱਚ ਇਹ ਬਹੁਤ ਪ੍ਰਸਿੱਧ ਨਾਲ ਮਨਾਇਆ ਜਾਂਦਾ ਹੈ ਭੰਗੜਾ ਬਹੁਤ ਪੰਜਾਬੀ ਬਾਹਰ ਬਾਹਰਲੇ ਦੇਸ਼ਾਂ ਵਿੱਚ ਪਾ ਰਹੇ ਹਨ